ਪਹਿਲੀ ਗੱਲ ਤਾਂ ਸਾਡੇ ਘਰਾਂ ਦੇ ਵਿੱਚ ਲਾਈਟ ਜਿਹੜੀ ਬਿਜਲੀ ਦਾ ਕੱਟ ਹੈ ਉਹ ਬਹੁਤ ਹੀ ਘੱਟ ਲੱਗਦਾ ਹੈ ਪਰ ਜੇ ਜਦੋਂ ਲੱਗਦਾ ਹੈ ਤਾਂ ਬਹੁਤ ਲੰਬੇ ਟਾਈਮ ਲਈ ਲੱਗ ਜਾਂਦਾ ਹੈ ਅਤੇ ਉਸ ਟਾਈਮ ਦੇ ਵਿੱਚ ਸਾਨੂੰ ਬਹੁਤ ਸਾਰੀ ਦਿੱਕਤਾਂ ਆਉਂਦੀਆਂ ਨੇ ਜਿਵੇਂ ਗਰਮੀ ਦੇ ਮੌਸਮ ਦੀ ਗੱਲ ਕਰਨੀ ਆਪਾਂ ਗਰਮੀ ਦੇ ਮੌਸਮ ਦੇ ਵਿੱਚ ਜਦੋਂ ਲਾਈਟ ਭੱਜ ਜਾਂਦੀ ਹੈ ਬਿਜਲੀ ਦਾ ਕੱਟ ਲੱਗਦਾ ਹੈ ਅਤੇ ਉਦੋਂ ਸਾਡੇ ਏਸੀ ਕੂਲਰ ਪੱਖੇ ਚੱਲਣੇ ਬੰਦ ਹੋ ਜਾਂਦੇ ਹਨ ਕਿਉਂਕਿ ਜਿਹੜੇ ਇਨਵੇਟਰ ਹੁੰਦੇ ਹਨ ਉਹ ਵੀ ਜ਼ਿਆਦਾ ਟਾਈਮ ਨਹੀਂ ਕੱਢ ਸਕਦੇ ਅਤੇ ਉਸ ਟਾਈਮ 'ਤੇ ਬਿਜਲੀ ਦਾ ਕੱਟ ਬਹੁਤ ਲੰਬਾ ਲੱਗ ਜਾਂਦਾ ਹੈ ਅਤੇ ਜਿਵੇਂ ਸਰਦੀਆਂ ਦੇ ਵਿੱਚ ਜਦੋਂ ਜਾਂਦੀ ਹੈ ਉਦੋਂ ਸਾਡੇ ਜਿਵੇਂ ਮਸ਼ੀਨ ਕੱਪੜੇ ਧੋਣ ਵਾਲ਼ੀ ਉਹ ਨਹੀਂ ਚੱਲ ਪਾਉਂਦੀ ਹੈਗੀ ਕਿਉਂਕਿ ਸਰਦੀਆਂ ਦੇ ਵਿੱਚ ਧੁੱਪ ਘੱਟ ਨਿਕਲਦੀ ਹੈ ਅਤੇ ਕੱਪੜੇ ਜਿਹੜੇ ਹੁੰਦੇ ਹੈ ਉਹ ਗਿੱਲੇ ਰਹਿ ਜਾਂਦੇ ਹੈ ਅਤੇ ਅਸੀਂ ਉਨ੍ਹਾਂ ਨੂੰ ਸੁਕਾ ਨਹੀਂ ਸਕਦੇ ਹੈ ਅਤੇ ਜਿਵੇਂ ਬਹੁਤ ਜ਼ਿਆਦਾ ਸਾਡੇ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਉਨ੍ਹਾਂ ਨੂੰ ਠੰਡ ਲੱਗਦੀ ਹੈ ਤਾਂ ਉਨ੍ਹਾਂ ਦੇ ਵਾਸਤੇ ਸਾਨੂੰ ਹੀਟਰ ਲਾਉਣਾ ਪੈਂਦਾ ਅਤੇ ਉਹ ਹੀਟਰ ਨਹੀਂ ਅਸੀਂ ਲਗਾ ਪਾਉਂਦੇ ਅਤੇ ਬਾਰਿਸ਼ਾਂ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਦਿੱਕਤ ਇਹ ਆਉਂਦੀ ਹੈ ਕਿ ਜਦੋਂ ਬਾਰਿਸ਼ ਜਾਂ ਹਨ੍ਹੇਰੀ ਤੂਫਾਨ ਕੁਛ ਵੀ ਐਵੇਂ ਦਾ ਹੁੰਦਾ ਹੈ ਤਾਂ ਉਦੋਂ ਜਿਹੜੇ ਬਿਜਲੀ ਦੇ ਖੰਭੇ ਹੁੰਦੇ ਹਨ ਉਹ ਟੁੱਟ ਜਾਂਦੇ ਹਨ ਅਤੇ ਉਨ੍ਹਾਂ ਦੇ ਕਰਕੇ ਫਿਰ ਚਾਰ ਚਾਰ ਪੰਜ ਪੰਜ ਦਿਨ ਬਿਜਲੀ ਆਉਂਦੀ ਹੀ ਨਹੀਂ ਹੈ ਅਤੇ ਉਹਦੇ ਕਰਕੇ ਸਾਰਿਆਂ ਦੇ ਘਰਾਂ ਦੇ ਵਿੱਚ ਨਾ ਤਾਂ ਪਾਣੀ ਹੁੰਦਾ ਹੈ ਨਾ ਲਾਈਟ ਹੁੰਦੀ ਹੈ ਨਾ ਤਾਂ ਬੱਚਿਆਂ ਨੂੰ ਕੋਈ ਫੈਸੇਲਿਟੀ ਪ੍ਰੋਵਾਈਡ ਕਰਵਾ ਪਾਉਂਦੇ ਹੈ ਤਾਂ ਉਸ ਟਾਈਮ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ